ਹਾਂਜੀ ਮੈਂ ਆਪਣੀ ਫ਼ਰੈਂਡ ਨੂੰ ਗਰੀਟਿੰਗ ਕਾਰਡ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਂਟਿੰਗ ਦੇ ਰੂਪ ਵਿੱਚ ਡਿਜ਼ਾਇਨ ਕਰਕੇ ਦਿੱਤਾ ਹੈ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਹੈ ਅਤੇ ਮੈਂ ਹੁਣ ਤੱਕ ਪੇਂਟਿੰਗ ਵਿੱਚ ਬਹੁਤ ਵਧੀਆ ਗਰੀਟਿੰਗ ਕਾਰਡ ਤਿਆਰ ਕੀਤੇ ਹਨ ਅਤੇ ਮੈਂ ਆਪਣੀ ਫ਼ਰੈਡਾਂ ਨੂੰ ਭੇਜਦੀ ਹਾਂ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਹੈ ਅਤੇ ਹੱਥ ਨਾਲ਼ ਪੇਂਟਿੰਗ ਕਰਨਾ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਹਦੇ ਵਿੱਚ ਇਹ ਸਾਫ਼ ਸੁਥਰਾ ਕੰਮ ਹੈ ਅਤੇ ਇਸਨੂੰ ਕਰਨਾ ਬਹੁਤ ਅਸਾਨ ਹੈ ਅਤੇ ਰੰਗ ਬਰੰਗੇ ਗਰੀਟਿੰਗ ਕਾਰਡ ਮੈਨੂੰ ਬਹੁਤ ਵਧੀਆ ਲੱਗਦੇ ਹਨ